ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਜੋ ਵੱਧ ਰਹੀਆਂ ਹੈ ਬਿਮਾਰੀਆਂ ਨੇ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜੋ ਅਸੀਂ ਅਨਾਜ ਅੰਨ ਜੋ ਵੀ ਅਸੀਂ ਗ੍ਰਹਣ ਕਰ ਰਹੇ ਹਾਂ ਇਹ ਸਭ ਦਵਾਈਆਂ ਦੇ ਕਾਰਨ ਯੂਰੀਆ ਖਾਦਾਂ ਦੇ ਕਾਰਨ ਖਾਣਾ ਨਾ ਰਹਿ ਕਰਕੇ ਆਹਾਰ ਨਾ ਰਹਿ ਕਰਕੇ ਇੱਕ ਵਿਸ਼ ਬਣ ਚੁੱਕਿਆ ਜ਼ਹਿਰ ਬਣ ਚੁੱਕਿਆ ਅਤੇ ਇਸ ਕਾਰਨ ਕੀ ਹੋ ਰਿਹਾ ਹੈ ਅਸੀਂ ਜੋ ਵੀ ਅਨਾਜ ਖਾ ਰਹੇ ਹਾਂ ਉਹ ਸਾਨੂੰ ਤਾਕਤ ਦੇਣ ਦੀ ਬਜਾਏ ਬਿਮਾਰੀਆਂ ਦੇ ਰਿਹਾ ਹੈ ਫੇਰ ਸਾਡੇ ਘਰਾਂ ਵਿੱਚ ਵੱਧ ਰਹੇ ਕਲੇਸ਼ ਸਾਡੇ ਭਵਿੱਖ ਵਿੱਚ ਆਉਣ ਵਾਲੀਆਂ ਚਿੰਤਾਵਾਂ ਦਾ ਭੰਡਾਰ ਇਕੱਠਾ ਕਰਨਾ ਟੈਂਨਸ਼ਨਾਂ ਦੇ ਕਾਰਨ ਇੱਕ ਚੰਗੇ ਭਲੇ ਬੰਦੇ ਨੂੰ ਵੀ ਬਿਮਾਰੀਆਂ ਲੱਗ ਰਹੀਆਂ ਹਨ ਸ਼ੂਗਰ ਕੋਈ ਬਿਮਾਰੀ ਨਹੀਂ ਹੈ ਅਗਰ ਸਾਨੂੰ ਟੈਨਸ਼ਨ ਹੈ ਸਾਨੂੰ ਸ਼ੂਗਰ ਆਪਣੇ ਆਪ ਹੋਵੇਗੀ ਬੀ ਪੀ ਕੋਈ ਬਿਮਾਰੀ ਨਹੀਂ ਹੈ ਅਗਰ ਸਾਨੂੰ ਟੈਨਸ਼ਨ ਹੈ ਸਾਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋਵੇਗੀ ਹੋਵੇਗੀ ਸਿਰ ਦਰਦ ਕਰਨਾ ਨੀਂਦ ਨ ਨਹੀਂ ਆਉਣਾ ਸਾਨੂੰ ਘਬਰਾਹਟ ਹੋਣਾ ਤਰੇਲੀਆਂ ਆਉਣਾ ਪਸੀਨੇ ਆਉਣੇ ਇਹ ਕੋਈ ਬਿਮਾਰੀਆਂ ਨਹੀਂ ਹਨ ਇਹ ਸਿਰਫ ਸਾਡੀ ਜੋ ਟੈਨਸ਼ਨ ਦੀ ਬਿਮਾਰੀ ਦੇ ਕਾਰਨ ਇਹ ਸਾਰੇ ਰੋਗ ਹੋ ਰਹੇ ਹਨ ਇਸ ਲਈ ਸਮੇਂ ਐਸਾ ਹੈ ਕਿ ਵਿਅਕਤੀ ਅਗਰ ਈਸ਼ਵਰ ਵੱਲ ਪਰਮਾਤਮਾ ਵੱਲ ਉਨਮੁੱਖ ਹੋਵੇ ਉਹਦੇ ਵੱਲ ਵਧੇ ਤਾਂ ਅਸੀਂ ਟੈਨਸ਼ਨ ਤੋਂ ਰਹਿਤ ਹੋ ਸਕਦੇ ਹੈ ਅਸੀਂ ਬਿਮਾਰੀਆਂ ਤੋਂ ਰਹਿਤ ਹੋ ਸਕਦੇ ਹੈ ਧੰਨਵਾਦ